ਹੈਲੋ ਐਚਪੀ ਗੈਸ ਏਜੰਸੀ ਤੋਂ ਬੋਲ ਰਹੇ ਹੋ ਹਾਂਜੀ ਜੀ ਗੈਸ ਬੁਕਿੰਗ ਦੀ ਸਥਿਤੀ ਪਤਾ ਕਰਨੀ ਹੈ ਜੀ ਹਾਂਜੀ ਸੰਦਰਭ ਨੰਬਰ ਮੇਰਾ ਹੈਗਾ ਜੀ ਨੌਂ ਇੱਕ ਅੱਠ ਚਾਰ ਦੋ ਚਾਰ ਤਿੰਨ ਇੱਕ ਚਾਰ ਛੇ ਨੌਂ ਦੋ ਅੱਠ ਇੱਕ ਹਾਂਜੀ ਆਧਾਰ ਕਾਰਡ ਨੰਬਰ ਹੈ ਜੀ ਅੱਠ ਛੇ ਚਾਰ ਇੱਕ ਇੱਕ ਦੋ ਛੇ ਸੱਤ ਅੱਠ ਨੌਂ ਜੀਰੋ ਇੱਕ ਦੋ ਤਿੰਨ ਚਾਰ ਪੰਜ ਹਾਂਜੀ ਗੈਸ ਸਲੰਡਰ ਦੀ ਕਦੋਂ ਅਵੇਲੇਬਿਲਟੀ ਹੋਊਗੀ ਹਾਂਜੀ ਮੋਬਾਈਲ ਨੰਬਰ ਜਿਹੜਾ ਹੈਗਾ ਨੌਂ ਨੌਂ ਅੱਠ ਅੱਠ ਇੱਕ ਨੌਂ ਨੌਂ ਅੱਠ ਅੱਠ ਛੇ ਹਾਂਜੀ ਐਡਰੈਸ ਹੈਗਾ ਕੇਐਮਬੀ ਕਾਲਜ ਦੇ ਪਿਛਲੇ ਪਾਸੇ ਸੰਤੋਖਪੁਰਾ

ਠੀਕ ਹੈ ਜੀ ਕੱਲ ਮਿਲ ਜਾਏਗਾ ਜੀ ਠੀਕ ਹੈ ਜੀ ਸ਼ੁਕਰੀਆ ਜੀ